ਪੰਜਾਬ ਵਿੱਚ ਵੱਖ ਵੱਖ ਧਾਰਮਿਕ ਸਥਾਨ ਹੈ ਜਿੱਦਾਂ ਪੂਜਾ ਸਥਾਨ ਵੀ ਹਨ ਜਿਵੇਂ ਮੰਦਰ ਮਸਜਿਦ ਚਰਚ ਮੰਦਰ ਹਰ ਇੱਕ ਦੇਵੀ ਦੇਵਤੇ ਦਾ ਪੰਜਾਬ ਦੇ ਵਿੱਚ ਮੰਦਰ ਹੈ ਹਿਸਟੋਰੀਕਲ ਪਲੇਸ ਐਂ ਸ਼ਿਵਜੀ ਦੇ ਐਂ ਕਾਲੀ ਮਾਤਾ ਦੇ ਹੈ ਅਤੇ ਮਸਜਿਦ ਹੈ ਮਾਣ ਖੁਸ਼ਰੀਫ ਹੈਗੀ ਹੈ ਫਤਿਹਗੜ੍ਹ ਸਾਹਿਬ ਰੋਜਾ ਸ਼ਰੀਫ ਹੈ ਚਰਚ ਹੈਗੇ ਹੈ ਚਰਚ ਹਿਸਟੋਰੀਕਲ ਚਰਚ ਸੈਕਟਰ ਉੱਨੀ ਦੇ ਵਿੱਚ ਚੰਡੀਗੜ੍ਹ ਹੈ ਅਤੇ ਪੰਜਾਬ ਦੇ ਵਿੱਚ ਖਰੜ ਹੈਗਾ ਮੱਠ ਕੁਛ ਘੱਟ ਪਾਏ ਜਾਂਦੇ ਆ ਪੰਜਾਬ ਦੇ ਵਿੱਚ ਜਿਹ ਜਿਹੜੇ ਕਿ ਬ ਬੋਧੀਆਂ ਦੇ ਧਰਮ ਸਥਾਨ ਹੁੰਦੇ ਹਨ